ਪਟਿਆਲੇ ਜ਼ਿਲ੍ਹੇ ਵਿੱਚ ਬਹੁਤ ਬਦਲਾਅ ਆਏ ਹਨ ਨੰਬਰ ਇੱਕ ਤੋਂ ਨਵਾਂ ਬੱਸ ਅੱਡਾ ਬਣਿਆ ਹੈ ਅਤੇ ਪਹਿਲਾਂ ਕਿਲਾ ਚੌਂਕ ਬਹੁਤ ਹੀ ਖ਼ਰਾਬ ਹਾਲਤ ਵਿੱਚ ਸੀ ਅਤੇ ਹੁਣ ਉਸ ਦੀ ਇਮਾਰਤ ਬਹੁਤ ਸੁੰਦਰ ਬਣਾਈ ਜਾ ਰਹੀ ਹੈ ਪਟਿਆਲੇ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਆਈਆਂ ਹਨ ਅਤੇ ਇਹ ਬਹੁਤ ਹੀ ਸੋਹਣਾ ਸ਼ਹਿਰ ਹੈ ਪਹਿਲਾਂ ਲੋਕ ਹੱਥ ਦੇ ਨਾਲ਼ ਕਢਾਈ ਕਰਦੇ ਸੀ ਰੁਮਾਲੇ ਵਗੈਰਾ ਕੱਢਦੇ ਸੀ ਅਤੇ ਸਿਹਰੇ ਦੀਆਂ ਪੱਟੀਆਂ ਵੀ ਬਣਾਉਂਦੇ ਸਨ ਪਟਾਰੀਆਂ ਥਾਲ ਥੈਲੀਆਂ ਅੱਜ ਕੱਲ੍ਹ ਤਾਂ ਇਹ ਕੰਪਿਊਟਰ ਤੇ ਜ਼ਮਾਨਾ ਆ ਗਿਆ ਹੈ ਕੰਪਿਊਟਰ ਰਾਹੀਂ ਕਰਨ ਲੱਗ ਗਏ ਜੋ ਕਿ ਕਾਰੀਗਰਾਂ ਨੂੰ ਬਹੁਤ ਹੀ ਘਾਟਾ ਪੈ ਰਿਹਾ ਹੈ ਕੰਪਿਊਟਰ ਨਾਲ਼ ਆਉਣ ਕਾਰਨ ਇਸ ਕਰਕੇ ਕਾਰੀਗਰਾਂ ਨੂੰ ਬਹੁਤ ਹੀ ਘਾਟਾ ਪੈ ਰਿਹਾ ਹੈ